ਮੈਂ ਇੱਕ ਦੁਕਾਨਦਾਰ ਹਾਂ ਜੋ ਕਿ ਮੈਨੂੰ ਵਹੀ ਉੱਤੇ ਹਿਸਾਬ ਲਿਖਣ ਵਿੱਚ ਦਿੱਕਤਦਾਰੀ ਹੁੰਦੀ ਹੈ ਜੋ ਕਿ ਮੈਂ ਇੱਕ ਪਲੈਨ ਬਣਾਇਆ ਕਿ ਮੈਂ ਛੋਟਾ ਸਾ ਛੋਟਾ ਜਿਹਾ ਟੈਬਲੈਟ ਖਰੀਦ ਲਵਾਂ ਇਸ ਬਾਰੇ ਮੈਨੂੰ ਮੇਰੇ ਦੋਸਤ ਨੇ ਦੱਸਿਆ ਕਿ ਤੂੰ ਆਨਲਾਈਨ ਜਿਵੇਂ ਕਿ ਐਮਾਜੋਨ 'ਤੇ ਟਰਾਈ ਕਰ ਉਸ 'ਤੇ ਚੰਗੀਆਂ ਓਫਰਾਂ ਆਉਂਦੀਆਂ ਹਨ ਉਸ ਵਿੱਚ ਮੈਂ ਉਸਦੇ ਕਹਿਣ 'ਤੇ ਐਮਾਜੋਨ ਉੱਤੇ ਆਨਲਾਈਨ ਸ਼ਾਪਿੰਗ ਕਰਨ ਵਿੱਚ ਦਿਲਚਸਪੀ ਦਿਖਾਈ ਉਸ ਵਿੱਚ ਮੈਂ ਕਈ ਤਰ੍ਹਾਂ ਦੇ ਟੈਬਲਟ ਖੋਜੇ ਜੋ ਕਿ ਮੇਰੇ ਬਜਟ ਤੋਂ ਵੀ ਬਾਹਰ ਸੀ ਅਤੇ ਉਂਝ ਕੁਛ ਚੰਗੇ ਵੀ ਨਹੀਂ ਲੱਗ ਰਹੇ ਸੀ ਇਸ ਕਰਕੇ ਉਸਨੇ ਮੈਨੂੰ ਫਿਰ ਸੁਝਾਅ ਦਿੱਤਾ ਕਿ ਤੂੰ ਇੱਕ ਹੋਰ ਦੂਸਰੀ ਐਪ ਹੈ ਫਲਿੱਪ ਕਾਰਟ ਤੂੰ ਉਸ 'ਤੇ ਜਾ ਕੇ ਦੇਖ ਫਿਰ ਮੈਂ ਉਸ ਦੂਸਰੀ ਐਪ 'ਤੇ ਜਾ ਕੇ ਚੈੱਕ ਕਰਨ ਲੱਗਿਆ ਤਾਂ ਉਸ ਵਿੱਚ ਮੈਨੂੰ ਕੁਛ ਚੰਗੇ ਟੈਬਲੇਟ ਮਿਲੇ ਜੋ ਕਿ ਵਾਜਬ ਰੇਟਾਂ 'ਤੇ ਸੀ ਇਸ ਲਈ ਮੈਂ ਉਹਨੂੰ ਦੇਖ ਦੇਖ ਕੇ ਇੱਕ ਟੈਬਲੈਟ ਜੋ ਕਿ ਮੈਨੂੰ ਪਸੰਦ ਆਇਆ ਜਿਸ ਦੀ ਕੀਮਤ ਪੰਦਰ੍ਹਾਂ ਹਜ਼ਾਰ ਰੁਪਏ ਸੀ ਪਰ ਮੈਂ ਉਸਨੂੰ ਸਟੋਰ ਕਰ ਕਰ ਲਿਆ ਅਤੇ ਦੇਖਣ ਲੱਗਿਆ ਕਿ ਮੇਰੇ ਅਕਾਊਂਟ 'ਚ ਕੀ ਬੈਲੈਂਸ ਹੈ ਇਸ ਤੋਂ ਬਾਅਦ ਮੈਨੇ ਆ ਆਪਣਾ ਬੈਲੈਂਸ ਚੈੱਕ ਕੀਤਾ ਤਾਂ ਕਿ ਜੋ ਕਿ ਮੇਰੇ ਬੈਲੈਂਸ ਵਿੱਚ ਅਠਾਰ੍ਹਾਂ ਹਜ਼ਾਰ ਰੁਪਏ ਸੀ ਫਿਰ ਮੈਨੂੰ ਟੈਬਲੇਟ ਲੈਣ 'ਚ ਕੋਈ ਦਿੱਕਤ ਨਹੀਂ ਹੋਈ ਮੈਂ ਉਹ ਟੈਬਲਟ ਆਨਲਾਈਨ ਪੰਦਰ੍ਹਾਂ ਹਜ਼ਾਰ ਰੁਪਏ ਆਨਲਾਈਨ ਪੇਮੈਂਟ ਕਰਕੇ ਉਹ ਟੈਬਲੇਟ ਦਾ ਔਡਰ ਦੇ ਦਿੱਤਾ ਜੋ ਕਿ ਮੈਨੂੰ ਦੋ ਚਾਰ ਦਿਨਾਂ ਵਿੱਚ ਰਿਸੀਵ ਹੋਜੂਗੀ